ਰੋਜ਼ ਸਵੇਰੇ ਪਹਿਲਾਂ ਪੰਜ ਕਿਲੋਮੀਟਰ ਭੱਜਣ ਜਾਓ ਫਿਰ ਜਦੋਂ ਵਾਪਿਸ ਆਓ ਤਾਂ ਵਧੀਆ ਭਾਰੀ ਨਾਸ਼ਤਾ ਕਰੋ ਜਿਹਦੇ 'ਚ ਤੁਸੀਂ ਦੋ ਤਿੰਨ ਅੰਡੇ ਖਾਓ ਪੀਨਟ ਬਟਰ ਖਾਓ ਦੁੱਧ ਪੀਓ ਘਿਓ ਖਾਓ ਅਤੇ ਰੋਜ਼ ਸ਼ਾਮ ਘੰਟਾ ਡੇਢ ਘੱਟ ਤੋਂ ਘੱਟ ਐਕਸਰਸਾਈਜ਼ ਕਰੋ ਜਾਂ ਕੋਈ ਖੇਡ ਖੇਡੋ ਜਿਹਦੇ ਨਾਲ ਤੁਹਾਡੀ ਲਚਕ ਵਿੱਚ ਬਰਕਤ ਹੋਵੇ ਫਿਰ ਅਗਰ ਤੁਸੀਂ ਐਕਸਰਸਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਡੰਡ ਲਗਾ ਸਕਦੇ ਹੋ ਸੀਟਪਸ ਲਗਾ ਸਕਦੇ ਹੋ ਚਿਨਪਸ ਲਗਾ ਸਕਦੇ ਹੋ ਅਤੇ ਰੋਜ਼ ਦੇ ਅਗਰ ਤੁਸੀਂ ਵੀਹ ਵੀਹ ਡੰਡ ਵੀਹ ਸੀਟਪਸ ਵੀਹ ਚਿਨਪਸ ਲਾਓ ਤਾਂ ਉਤਲੇ ਸਰੀਰ ਦੇ ਵਿੱਚ ਤਾਕਤ ਦੀ ਬਰਕਤ ਹੁੰਦੀ ਹੈ ਰਾਤੀ ਜ਼ਿਆਦਾ ਨਾ ਖਾਓ ਕਿਉਂਕਿ ਉਸ ਤੋਂ ਬਾਅਦ ਸੋਣਾ ਹੁੰਦਾ ਹੈ ਅਤੇ